ਹੈਲੋ ਵਧੀਆ ਜੀ ਤੁਸੀਂ ਦੱਸੋ ਵਧੀਆ ਜੀ ਵਧੀਆ ਵਧੀਆ ਜੀ ਅੱਛਾ ਜੀ ਮੈਂ ਪਛਾਣਿਆ ਨਹੀਂ ਜੀ ਕੀ ਪਹਿਲਾਂ ਕੋਈ ਕੰਮ ਕੀਤਾ ਜਿਵੇਂ ਕਿ ਕਿਹੜਾ ਗਾਣਾ ਅੱਛਾ ਜੀ ਹੋਰ ਕਿਹੜੇ 'ਚ ਕੀਤਾ ਅੱਛਾ ਜੀ ਅਤੇ ਫਿਲਮ ਫਿਲਮ 'ਚ ਐਕਟ ਕੀਤਾ ਕੋਈ

ਅੱਛਾ ਜੀ ਅੱਛਾ ਅੱਛਾ ਠੀਕ ਆ ਉਹ ਗੁਰ ਕਮਲ ਅੱਛਾ ਠੀਕ ਆ ਹੁਣ ਸਮਝ ਗਿਆ ਜੀ ਹਾਂਜੀ ਹਾਂਜੀ ਹਾਂਜੀ ਠੀਕ ਆ ਠੀਕ ਆ ਮੈਂ ਵੀ ਸੋਚ ਰਿਹਾ ਸੀ ਤੁਹਾਡੇ ਬਾਰੇ ਵੀ ਲਈਏ ਤੁਹਾਨੂੰ ਕਿਸੇ ਫਿਲਮ 'ਚ ਹਾਂ ਕਰਨੀ ਆ ਫਿਲਮ ਹੁਣ ਇੱਕ ਕਰਦੇ ਹਾਂ ਡਾਇਰੈਕਟ ਕਰਨਾ ਲਿਖਣੀ ਆ ਹੁਣ ਹੁਣ ਹਾਂ ਹੁਣ ਦੇਖਦੇ ਹਾਂ ਅਗਲੇ ਮਹੀਨੇ ਦੇਖਦੇ ਹਾਂ ਹਾਂਜੀ ਹੁਣ ਤਾਂ ਮੈਂ ਚੰਡੀਗੜ੍ਹ ਆਇਆ ਹੋਇਆ ਸੀਗਾ ਉਹ ਵੀ ਫਿਲਮ ਦੀ ਸ਼ੂਟਿੰਗ ਜੀ ਚੱਲਦੀ ਸੀ ਇੱਕ ਦੀ

ਹੈਲੋ ਅੱਛਾ ਜੀ ਅੱਛਾ ਹਾਂਜੀ ਅੱਛਾ ਜੀ ਹਾਂਜੀ ਹਾਂਜੀ

ਆਪਣਾ ਹੈਗਾ ਵਾ ਉਹ ਵਾਲਾ ਜੀ ਕੌਣ ਬਣੇਗਾ ਛਿੰਦਾ ਤੁਹਾਨੂੰ ਦੇਖਾਂਗੇ ਜੀ ਮੇਰਾ ਮੇਨ ਮੇਨ ਰੋਲ ਦੀ ਦਿਵਾਵਾਂਗੇ ਹੀਰੋ ਦੀ ਮੈਨੂੰ ਤੁਹਾਡੀ ਵੀ ਮੈਨੂੰ ਤੁਹਾਡੀ ਐਕਟਿੰਗ ਪਸੰਦ ਆਈ ਸੀਗੀ ਹੈਲੋ ਹਾਂਜੀ ਧੰਨਵਾਦ ਤਾਂ ਕਾਹਦਾ ਜੀ ਕ ਕਲਾਕਾਰੀ ਤਾਂ ਤੁਹਾਡੀ ਆ ਹਾਂਜੀ ਹੁਣ ਜਿਵੇਂ ਕਰੋ ਹਾਂਜੀ ਫੇਰ ਹਾਂਜੀ ਹੋਰ ਤਾਂ ਵਧੀਆ ਅਤੇ ਉਹ ਹੁਣ ਕਿੱਥੇ ਹੋ ਤੁਸੀਂ ਅੱਛਾ ਮੈਂ ਚੰਡੀਗੜ੍ਹ ਦੀ ਮੈਂ ਅਗਲੇ ਹਫ਼ਤੇ ਆਉਂਗਾ ਲੁਧਿਆਣੇ ਮੇਰੇ ਆਫਿਸ 'ਚ ਹਾਂਜੀ ਅਤੇ ਆਪਾਂ ਉਥੇ ਬਹਿ ਕੇ ਮੀਟਿੰਗ ਕਰਾਂਗੇ ਜੇ ਤੁਹਾਨੂੰ ਪਸੰਦ ਹੋਇਆ ਰੋਲ ਤਾਂ ਦੱਸਿਓ ਹਾਂਜੀ ਅਤੇ ਬਾਕੀ ਆਪਾਂ ਹੀਰੋਇੰਨ ਵੀ ਦੇਖ ਲਾਂਗੇ ਉੱਥੇ ਬਹਿ ਕੇ ਵੀ ਕਿਹੜੇ ਲੈਣੇ ਮੈਂ ਸੋਚਦਾ ਮਾਹੀ ਸ਼ਰਮਾ ਲੈ ਲਈਏ ਹਾਂਜੀ ਸੋਨਮ ਬਾਜਵਾ ਫਿਰ ਉਹ ਬਜਟ ਦਾ ਫਰਕ ਪੈਂਦਾ ਬਜਟ ਦਾ ਫਰਕ ਪੈਂਦਾ ਹਾਜੀ ਬਾਕੀ ਆਪਾਂ ਪ੍ਰੋਡਿਊਸਰ ਨਾਲ ਗੱਲ ਕਰਾਂਗੇ ਜੇ ਉਹਦਾ ਉਹ ਬਜਟ ਵਧਾਉਂਦਾ ਹੋਇਆ ਉਹ ਤਾਂ ਹੁਣ ਜੀ ਮੌਕੇ 'ਤੇ ਦੇਖਾਂਗੇ ਕਿ ਕਿਹੜੀ ਐਕਟਰਸ ਲਿਆ ਹਾਂਜੀ ਹਾਂਜੀ ਉਹ ਤਾਂ ਕੋਈ ਨਹੀਂ ਉਹ ਤਾਂ ਮਿਲੇ ਜਾਣੀ ਆ ਲੁਧਿਆਣੇ ਆ ਜਿਓ ਮੇਰੇ ਆਫਿਸ ਵਿੱਚ ਤੁਹਾਨੂੰ ਪਤਾ ਹੀ ਹੋਣਾ ਇਧਰ ਮੈਂ ਆਉਂਗਾ ਜੀ ਅਗਲੇ ਹਫ਼ਤੇ ਬੁੱਧਵਾਰ ਨੂੰ ਆਊਂਗਾ ਜੀ ਹਾਂਜੀ ਓਕੇ ਜੀ ਓਕੇ